ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਬੱਚੇ ਨੂੰ ਗੁੜਤੀ ਦਿੱਤੀ ਜਾਂਦੀ ਹੈ ਉਹ ਗੁੜਤੀ ਪਤਾਸ਼ਿਆਂ ਦੀ ਹੁੰਦੀ ਹੈ ਜਾਂ ਫਿਰ ਸ਼ਹਿਦ ਦੀ ਦਿੱਤੀ ਜਾਂਦੀ ਹੈ ਉਸ ਤੋਂ ਪਹਿਲਾਂ ਤਾਂ ਬੱਚੇ ਘਰ ਵਿੱਚ ਹੀ ਪੈਦਾ ਹੁੰਦੇ ਸੀ ਪਰ ਅੱਜ ਕੱਲ੍ਹ ਹੋਸਪਿਟਲ ਦੇ ਵਿੱਚ ਡਿਲੀਵਰੀ ਹੁੰਦੀ ਹੈ ਅਤੇ ਜਦੋਂ ਬੱਚੇ ਨੂੰ ਘਰ ਲਿਆਉਂਦਾ ਜਾਂਦਾ ਹੈ ਤਾਂ ਉਸਦਾ ਸਵਾਗਤ ਕੀਤਾ ਜਾਂਦਾ ਹੈ ਉਸਦੇ ਸਵਾਗਤ ਵਿੱਚ ਜਿਹੜੀ ਦਾਈ ਹੁੰਦੀ ਆ ਉਹ ਤੇਲ ਚੋਂਦੀ ਹੈ ਦਰਵਾਜ਼ੇ 'ਤੇ ਸ਼ਰੀਲ ਬੰਨਦੀ ਹੈ ਅਤੇ ਬੱਚੇ ਨੂੰ ਮਾਲਿਸ਼ ਕਰਦੀ ਅਤੇ ਨਵਾਉਂਦੀ ਹੈ ਇਸੇ ਤਰ੍ਹਾਂ ਹੀ ਮਾਂ ਦੀ ਵੀ ਮਾਲਿਸ਼ ਕੀਤੀ ਜਾਂਦੀ ਹੈ ਅਤੇ ਉਸਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਸਾਰਿਆਂ ਨੂੰ ਮਿਠਾਈ ਵੰਡੀ ਜਾਂਦੀ ਹੈ ਘਰ ਵਿੱਚ ਖ ਖੁਸ਼ੀ ਦਾ ਮਾਹੌਲ ਹੁੰਦਾ ਹੈ ਤੇਰ੍ਹਾਂ ਦਿਨਾਂ ਬਾਅਦ ਬੱਚੇ ਦੀ ਮਾਂ ਨੂੰ ਚੌਂਕੇ ਚੜ੍ਹਾਉਣ ਦੀ ਰਸਮ ਕੀਤੀ ਜਾਂਦੀ ਹੈ ਜੋ ਕਿ ਇੱਕ ਪਾਠੀ ਸਿੰਘ ਵੱਲੋਂ ਪੰਜ ਬਾਣੀਆਂ ਦਾ ਪਾਠ ਕਰਵਾ ਕੇ ਅਤੇ ਜਲ ਤਿਆਰ ਕਰਵਾ ਕੇ ਮਾਂ ਔਰ ਬੱਚੇ ਨੂੰ ਛਕਾਇਆ ਜਾਂਦਾ ਹੈ ਅਤੇ ਚੌਂ ਫਿਰ ਉਹਨਾਂ ਨੂੰ ਚੌਂਕੇ 'ਚ ਮਾਂ ਨੂੰ ਚੌਂਕੇ ਚੜ੍ਹਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਇੱਕੀ ਦਿਨ ਬਾਅਦ ਫਿਰ ਉਹਨਾਂ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ ਔਰ ਸਵਾ ਮਹੀਨੇ ਬਾਅਦ ਫਿਰ ਬੱਚੇ ਦਾ ਸਵੇ ਮਹੀਨੇ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ ਜਿਸ ਵਿੱਚ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਹਨ ਅਤੇ ਕੱਪੜੇ ਲੈ ਕੇ ਆਉਂਦੇ ਹਨ ਜਾਂ ਕੋਈ ਪੰਜੀਰੀ ਵਗੈਰਾ ਉਹਨਾਂ ਦੇ ਘਰ ਦੇ ਮਾਂਪੇ ਕੁੜੀ ਦੇ ਮਾਂਪੇ ਬਣਾ ਕੇ ਲੈ ਕੇ ਆਉਂਦੇ ਹਨ ਉਸਨੂੰ ਸਵਾ ਮਹੀਨਾ ਕਿਹਾ ਜਾਂਦਾ ਹੈ